ਅੱਜ ਕੱਲ੍ਹ ਖੇਤੀਬਾੜੀ ਦੇ ਕੰਮ ਨੂੰ ਉੱਚਾ ਚੁੱਕਣ ਵਾਸਤੇ ਕਈ ਤਰ੍ਹਾਂ ਦੇ ਦੀਆਂ ਨਵੀਆਂ ਤਕਨੀਕਾਂ ਚਲਾਈਆਂ ਜਾਂਦੀਆਂ ਹਨ ਜਿੰਨਾ ਰਾਹੀਂ ਕਿਸਾਨ ਫਸਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਝਾੜ ਲੈ ਸਕਣ ਜਿਸ ਕਰਕੇ ਆਪਣੇ ਕਿੱਤੇ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਫੁੱਲਤ ਕਰ ਸਕਣ ਇਹਨਾਂ ਦੇ ਇਸ ਕਿੱਤੇ ਵਿੱਚ ਸਰਕਾਰ ਵੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਕਿਸਾਨਾਂ ਲਈ ਖੇਤੀਬਾੜੀ ਦੇ ਮੇਲੇ ਲਗਾਏ ਜਾਂਦੇ ਹਨ ਜਿਸ ਵਿੱਚ ਕਿਸਾਨਾਂ ਨੂੰ ਨਵੀਆਂ ਤੋਂ ਨਵੀਆਂ ਫਸਲਾਂ ਅਤੇ ਤਕਨੀਕਾਂ ਦੀ ਵਰਤੋਂ ਬਾਰੇ ਦੱਸਿਆ ਜਾਂਦਾ ਹੈ ਹੋਰ ਕਿਸਾਨਾਂ ਨੂੰ ਇੰਟਰਨੈਟ ਰਾਹੀਂ ਵੀ ਕਾਫੀ ਜਾਣਕਾਰੀ ਦਿੱਤੀ ਜਾਂਦੀ ਹੈ